ਸਾਨੂੰ ਹੁਣ ਐਮਰਜੈਂਸੀ ਸੇਵਿੰਗਸ ਅਤੇ ਫੰਡ ਨੂੰ ਲੈ ਕੇ ਬਹੁਤ ਹੀ ਵੱਡੀ ਮੁਸੀਬਤ ਦਾ ਸਾਹਮਣਾ ਕਰਨਾ ਪਿਆ ਹੈ ਅਸੀਂ ਹੁਣੇ ਘਰ ਬਣਾਉਣਾ ਸੀਗਾ ਐਮਰਜੈਂਸੀ ਦੇ ਵਿੱਚ ਅਤੇ ਸਾਡੇ ਕੋਲ ਕੋਈ ਵੀ ਫੰਡਸ ਜਾਂ ਸੇਵਿੰਗਸ ਹੈ ਨਹੀਂ ਸੀਗੀਆਂ ਨਾ ਹੀ ਸਾਨੂੰ ਕਿਸੇ ਸਕੀਮਾਂ ਦਾ ਪਤਾ ਸੀ ਬੈਂਕ ਦੁਆਰਾ ਜਾਂ ਕੋਈ ਵੀ ਐਫ ਡੀ ਵਗੈਰਾ ਦਾ ਸਾਨੂੰ ਕੁਛ ਨਹੀਂ ਪਤਾ ਸੀ ਕੋਈ ਨਾਲੇਜ ਨਹੀਂ ਸੀਗੀ ਅਤੇ ਮੈਂ ਚਾਹੁੰਦੀ ਸੀਗੀ ਵੀ ਜੇ ਬੈਂਕ ਵਾਲੇ ਟਾਈਮ ਤੋਂ ਟਾਈਮ ਸਾਨੂੰ ਇਹ ਨੌਲੇਜ ਦਿੰਦੇ ਰਹਿਣ ਜਾਂ ਮੋਬਾਈਲ 'ਤੇ ਕੋਈ ਵੀ ਕਿਸੇ ਐਪ ਤੋਂ ਪਤਾ ਲੱਗਦਾ ਰਹੇ ਤਾਂ ਅਸੀਂ ਵੀ ਸੇਵਿੰਗ ਕਰਨ ਜੋਗੇ ਹੁੰਦੇ ਅਤੇ ਸਾਨੂੰ ਨੌਲੇਜ ਹੁੰਦੀ ਤਾਂ ਅਸੀਂ ਵੀ ਫੰਡਸ ਆਪਦੇ ਪ੍ਰੋਪਰ ਰੱਖਦੇ ਅਤੇ ਅਸੀਂ ਆਪਣਾ ਘਰ ਬਣਾ ਸਕਦੇ ਸੀਗੇ ਪਰ ਅੱਜ ਕੱਲ੍ਹ ਸਾਨੂੰ ਬਹੁਤ ਹੀ ਮੁਸੀਬਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪੈਸੇ ਅਰੇਂਜ ਕਰਨੇ ਬਹੁਤ ਔਖੇ ਹੋ ਗਏ ਹਨ ਨਾ ਹੀ ਅੱਜ ਕੱਲ੍ਹ ਕੋਈ ਰਿਸ਼ਤੇਦਾਰ ਹੈਲਪ ਕਰਦਾ ਹੈ ਅਤੇ ਨਾ ਹੀ ਕੁਝ ਹੋਰ ਇਸ ਲਈ ਸਾਨੂੰ ਘਰ ਬਣਾਉਣ 'ਚ ਬਹੁਤ ਹੀ ਜ਼ਿਆਦਾ ਦਿੱਕਤ ਆ ਰਹੀ ਹੈ